ਪੰਜਾਬ ਵਿੱਚ ਬਹੁਤ ਹੀ ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਲਗਾਈਆਂ ਜਾਂਦੀਆਂ ਹਨ ਬਹੁਤ ਸਾਰੀਆਂ ਫਸਲਾਂ ਹਨ ਜੋ ਕਿ ਕਿਸਾਨਾਂ ਦਾ ਆਮਦਨ ਸਰੋਤ ਹਨ ਜਿਵੇਂ ਕਿ ਕਣਕ ਝੋਨਾ ਕਪਾਹ ਸੂਰਜਮੁਖੀ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਹਨ ਜੋ ਕਿ ਕਿਸਾਨ ਆਪਣੀ ਖੇਤੀ ਵਿੱਚ ਲਗਾਉਂਦੇ ਹਨ ਜਿਵੇਂ ਕਿ ਆਲੂ ਗਾਜਰਾਂ ਗੋਭੀ ਮੂਲੀਆਂ ਅਤੇ ਬਹੁਤ ਹੋਰ ਵੀ ਜੇ ਗੱਲ ਕੀਤੀ ਜਾਵੇ ਕਣਕ ਦੀ ਤਾਂ ਇਹਦਾ ਆਪਣਾ ਖਾਸ ਟਾਈਮ ਹੈ ਜਿਵੇਂ ਕਿ ਅਕਤੂਬਰ ਵਿੱਚ ਇਸ ਨੂੰ ਲਗਾਇਆ ਜਾਂਦਾ ਹੈ ਅਤੇ ਮਾਰਚ ਵਿੱਚ ਇਸਦੀ ਵਾਢੀ ਹੁੰਦੀ ਹੈ ਵਿਸਾਖੀ ਦਾ ਮਹੀਨਾ ਆਮ ਗਿਣਿਆ ਜਾਂਦਾ ਹੈ ਜਿਸ ਵਿੱਚ ਕਣਕ ਦੀ ਵਾਢੀ ਹੁੰਦੀ ਹੈ ਜੋ ਕਿ ਅੰਗਰੇਜ਼ੀ ਮਹੀਨਾ ਮਾਰਚ ਹੀ ਹੁੰਦਾ ਹੈ ਗੱਲ ਕੀਤੀ ਜਾਵੇ ਝੋਨੇ ਦੀ ਤਾਂ ਇਹ ਜੁਲਾਈ ਵਿੱਚ ਲਗਾਇਆ ਜਾਂਦਾ ਹੈ ਅਤੇ ਅਕ ਅਕਤੂਬਰ ਵਿੱਚ ਇਸ ਦੀ ਵਾਢੀ ਹੁੰਦੀ ਹੈ ਕਪਾਹ ਜਿਹੜੀ ਕਿ ਇੱਕ ਸੌ ਸੱਠ ਜਾਂ ਇੱਕ ਸੌ ਪੈਂਹਠ ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਅਪ੍ਰੈਲ ਅਤੇ ਮਈ ਮਹੀਨਾ ਖਾਸ ਹੁੰਦਾ ਹੈ ਜੇ ਗੱਲ ਕੀਤੀ ਜਾਵੇ ਸੂਰਜਮੁਖੀ ਦੀ ਉਹ ਇੱਕ ਸੌ ਵੀਹ ਦਿਨਾਂ ਵਿੱਚ ਹੀ ਤਿਆਰ ਹੋ ਜਾਂਦੀ ਹੈ ਅਤੇ ਜਿਹੜੇ ਆਲੂ ਹਨ ਉਹ ਜਨਵਰੀ ਵਿੱਚ ਬੀਜੇ ਜਾਂਦੇ ਹਨ ਅਤੇ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਹੀ ਇਸਨੂੰ ਕੱਢ ਦਿੱਤਾ ਜਾਂਦਾ ਹੈ ਇਹ ਕੁਝ ਕੁ ਸਬਜ਼ੀਆਂ ਅਤੇ ਫਸਲਾਂ ਹਨ ਜੋ ਕਿ ਆਪਣੇ ਖਾਸ ਸਮੇਂ 'ਤੇ ਉੱਗਦੀਆਂ ਹਨ ਅਤੇ ਵੱਢੀਆਂ ਜਾਂਦੀਆਂ ਹਨ